ਹੈਲੋ ਨਮਸਕਾਰ ਸਰ ਮੈਂ ਜਿਹੜਾ ਤੁਹਾਡੇ ਕੋਲ ਆਰਡਰ ਕਰਵਾਇਆ ਸੀ ਆਪਣੇ ਬੇਟੇ ਦੇ ਜਨਮ ਦਿਨ 'ਤੇ ਜੋ ਕਿ ਦਾਲ ਮਖਣੀ ਦਹੀਂ ਮਟਰ ਪਨੀਰ ਆਦਿ ਸਮਾਨ ਦਾ ਤੁਹਾਨੂੰ ਆਰਡਰ ਦਿੱਤਾ ਸੀ ਦਰਅਸਲ ਇਹ ਸਮਾਨ ਮੇਰੇ ਬੇਟੇ ਦੇ ਮਾਮਾ ਜੀ ਨੇ ਦਾਲ ਮਖਣੀ ਦਹੀਂ ਪਨੀਰ ਆਦਿ ਕੇਕ ਦਾ ਆਰਡਰ ਆਲ ਰੈਡੀ ਬੁੱਕ ਕਰਵਾਇਆ ਸੀ ਜੋ ਕਿ ਮੈਂ ਆਪਣਾ ਦਿੱਤਾ ਹੋਇਆ ਆਰਡਰ ਆਪ ਕੋਲੋਂ ਵਾਪਸ ਲੈਣਾ ਚਾਹੁੰਦਾ ਹਾਂ ਕਿ ਇਹ ਬਾਡੇ ਦਾ ਸਰਪ੍ਰਾਈਜ਼ ਮੇਰੇ ਬੇਟੇ ਦੇ ਮਾਮਾ ਜੀ ਦੇ ਰਹੇ ਸਨ ਜੋ ਕਿ ਅਸੀਂ ਸਾਰੇ ਪਰਿਵਾਰ ਉੱਥੇ ਜਾਣਾ ਚਾਹੁੰਦੇ ਹਾਂ ਹੋ ਸਕੇ ਤਾਂ ਮੇਰਾ ਦਿੱਤਾ ਹੋਇਆ ਆਰਡਰ ਦਾ ਪੈਸਾ ਵਾਪਸ ਕੀਤਾ ਜਾਵੇ ਮੈਂ ਆਪਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ